ਹਾਂਜੀ ਮੈਂ ਕਰੀਬ ਦੋ ਕੁ ਘੰਟੇ ਪਹਿਲਾਂ ਕੈਬ ਬੁੱਕ ਕਰੀ ਸੀ ਚੰਡੀਗੜ੍ਹ ਲਈ ਪਰ ਮੈਂ ਆਪਣੀ ਲੋਕੇਸ਼ਨ 'ਤੇ ਪਹੁੰਚ ਗਈ ਅਤੇ ਤੁਸੀਂ ਮੈਨੂੰ ਉੱਥੇ ਨਹੀਂ ਮਿਲੇ ਅਤੇ ਮੈਨੂੰ ਕਿਸੇ ਐਮਰਜੈਂਸੀ ਕੰਮ ਲਈ ਜਾਣਾ ਸੀ ਪਰ ਮੈਂ ਤੁਹਾਡੀ ਉੱਥੇ ਬਹੁਤ ਵੇਟ ਕਰੀ ਜਿਸ ਕਾਰਨ ਮੈਂ ਲੇਟ ਵੀ ਹੋ ਚੁੱਕੀ ਸੀ ਅਤੇ ਤੁਸੀਂ ਆਪਣੇ ਟਾਈਮ ਉੱਤੇ ਨਹੀਂ ਪਹੁੰਚੇ ਸੋ ਮੈਂ ਅਲੱਗ ਤੋਂ ਇੱਕ ਹੋਰ ਕੈਬ ਬੁੱਕ ਕਰ ਲਈ ਹੈ ਪਰ ਤੁਹਾਡੀ ਗ਼ਲਤੀ ਦੇ ਕਾਰਨ ਮੇਰਾ ਬਹੁਤ ਜ਼ਿਆਦਾ ਸਮਾਂ ਬਰਬਾਦ ਹੋ ਗਿਆ ਹੈ ਪਰ ਮੈਂ ਸ਼ਰਮਿੰਦਾ ਹਾਂ ਕਿ ਮੈਂ ਤੁਹਾਨੂੰ ਪਹਿਲਾਂ ਤੋਂ ਕੰਮ ਕਰਨ ਲਈ ਕਿਹਾ ਸੀ ਪਰ ਤੁਹਾ ਪਰ ਤੁਹਾਡੀ ਗ਼ਲਤੀ ਕਾਰਨ ਹੀ ਮੈਨੂੰ ਅਲੱਗ ਤੋਂ ਕਿਸੇ ਹੋਰ ਨੂੰ ਬੁਲਾਉਣਾ ਪਿਆ ਅਤੇ ਮੈਂ ਉਸ ਨਾਲ਼ ਆਪਣੇ ਕੰਮ ਲਈ ਨਿਕਲ ਗਈ ਹਾਂ ਪਰ ਤੁਹਾਨੂੰ ਤੁਸੀਂ ਪਰ ਮਾਫ਼ ਕਰਨਾ ਕਿ ਤੁਸੀਂ ਮੈਂ ਤੁਹਾਡੀ ਕੈਬ ਲਈ ਹੁਣ ਨਹੀਂ ਆ ਸਕਦੀ ਅਤੇ ਤੁਸੀਂ ਕੋਈ ਹੋਰ ਕਸਟਮਰ ਦੇਖ ਲਓ